ਮੈਂ ਚੁਰਾਸੀ ਦੇ ਦੰਗਿਆਂ 'ਤੇ ਇੱਕ ਕਿਤਾਬ ਪੜ੍ਹੀ ਜਿਸਨੇ ਮੈਨੂੰ ਬਹੁਤ ਹੀ ਰਵਾਇਆ ਉਸਦੇ ਵਿੱਚ ਮੈਂ ਇੱਕ ਕਹਾਣੀ ਪੜ੍ਹੀ ਜਿਹਦੇ ਵਿੱਚ ਸ ਇੱਕ ਪੂਰੀ ਪੰਜਾਬੀ ਫੈਮਲੀ ਨੂੰ ਬੜੇ ਤਸੀਹੇ ਦੇ ਕੇ ਮਾਰਿਆ ਗਿਆ ਉਸਦੇ ਵਿੱਚ ਜੋ ਫੈਮਿਲੀ ਦੇ ਵਿੱਚ ਚਾਰ ਜੀਅ ਸੀਗੇ ਚਾਰਾਂ ਨੂੰ ਤਾਂ ਬੜੇ ਤਸੀਹੇ ਦੇ ਕੇ ਮਾਰਿਆ ਗਿਆ ਪਰ ਇੱਕ ਛੋਟਾ ਬੱਚਾ ਵੀ ਸੀ ਜਿਹਨੂੰ ਉਹ ਹਿੰਦੂ ਉਹਨਾਂ ਨੂੰ ਹਿੰਦੂ ਵੀ ਨਹੀਂ ਕਵਾਂਗੇ ਉਹਨਾਂ ਦਾ ਕੋਈ ਧਰਮ ਨਹੀਂ ਹੁੰਦਾ ਜਿਹੜੇ ਇਨਸਾਨੀਅਤ ਦੇ ਨਾਂ 'ਤੇ ਕਲੰਕ ਹੁੰਦੇ ਨੇ ਉਹ ਇਹੋ ਜਿਹੇ ਕੰਮ ਕਰਦੇ ਨੇ ਉਹਨਾਂ ਨੇ ਕੀ ਕੀਤਾ ਕਿ ਇੱਕ ਛੋਟੇ ਬੱਚੇ ਨੂੰ ਜੋ ਕਿ ਅਜੇ ਦੋ ਕੁ ਮਹੀਨਿਆਂ ਦਾ ਸੀ ਉਹਨੂੰ ਉਹਨੂੰ ਮਾਰਨ ਲਈ ਉਹਨਾਂ ਨੂੰ ਹੋਰ ਤਾਂ ਕੁਛ ਨਹੀਂ ਲੱਭਿਆ ਉਹਨਾਂ ਨੇ ਰਸੋਈ ਵਿੱਚ ਜਾ ਕੇ ਇੱਕ ਕੂਕਰ ਖੋਲ੍ਹਿਆ ਕੁੱਕਰ ਦੇ ਵਿੱਚ ਉਹ ਦੋ ਮਹੀਨੇ ਦੇ ਛੋਟੇ ਬੱਚੇ ਨੂੰ ਪਾ ਕੇ ਕੂਕਰ ਬੰਦ ਕਰ ਦਿੱਤਾ ਅਤੇ ਥੱਲੋਂ ਅੱਗ ਚਲਾ ਦਿੱਤੀ ਅਤੇ ਉਹ ਬੱਚਾ ਉੱਥੇ ਦਮ ਤੋੜ ਗਿਆ ਪਤਾ ਨਹੀਂ ਉਸ ਵਿਚਾਰੇ ਨਾਲ ਕੀ ਹੋਇਆ ਹੋਏਗਾ ਮੈਂ ਜਦੋਂ ਵੀ ਇਹ ਚੀਜ਼ ਯਾਦ ਕਰਦੀ ਹਾਂ ਜਾਂ ਇਹਨੂੰ ਮੇਰੇ ਦਿਮਾਗ ਵਿੱਚ ਆਉਂਦੀ ਹੈ ਮੇਰੇ ਲੂ ਕੰਢੇ ਖੜ੍ਹੇ ਹੋ ਜਾਂਦੇ ਨੇ ਮੈਂ ਇਸ ਤੋਂ ਅੱਗੇ ਕੁਛ ਹੋਰ ਬੋਲ ਹੀ ਨਹੀਂ ਪਾਉਂਦੀ